ਹਾਂਜੀ ਰੁਤਬਾ ਰੈਸਟੋਰੈਂਟ ਦੇ ਓਨਰ ਤੁਸੀਂ ਹੋ ਜੀ ਹਾਂਜੀ ਆਪਣੀ ਫ਼ੋਨ 'ਤੇ ਗੱਲ ਹੋਈ ਸੀ ਨਾ ਇੱਕ ਵਿਆਹ ਦਾ ਪ੍ਰੋਗਰਾਮ ਲਈ ਆਪਾਂ ਨੂੰ ਦੋ ਸੌ ਬੰਦਿਆਂ ਦੇ ਲਈ ਇੱਕ ਮਿੱਠਾ ਪਕਵਾਨ ਚਾਹੀਦਾ ਅਤੇ ਆਪਣੇ ਕੋਲ ਕੀ ਕੀ ਹੋਏਗਾ ਮਿੱਠੇ ਵਿੱਚ ਹਾਂਜੀ ਆਪਾਂ ਨੂੰ ਜਿਵੇਂ ਜਲੇਬੀ ਰਬੜੀ ਹੋ ਗਈ ਅਤੇ ਗੁਲਾਬ ਜਾਮੁਨ ਰਸਗੁੱਲਾ ਅਤੇ ਸਪੰਜੀ ਰਸਗੁੱਲਾ ਇਸ ਤੋਂ ਇਲਾਵਾ ਗਜਰੇਲਾ ਹੋ ਜਾਵੇਗਾ ਜੀ ਠੀਕ ਆ ਅਤੇ ਇਹ ਆਪਾਂ ਨੂੰ ਦੋ ਸੌ ਬੰਦੇ ਲਈ ਅਰੇਂਜਮੈਂਟ ਕਰਨਾ ਚਾਹੀਦਾ ਤੁਸੀਂ ਕਰ ਸਕਦੇ ਹੋ ਇਹ ਹਾਂਜੀ ਅਤੇ ਇਹਦਾ ਕੀ ਰੇਟ ਕਰੋਗੇ ਤੁਸੀਂ ਅਲੱਗ ਅਲੱਗ ਮੈਨੂੰ ਦੱਸੋਗੇ ਰੇਟ ਹਾਂਜੀ ਹਾਂਜੀ ਅਤੇ ਗੁਲਾਬ ਜਾਮੁਨ ਡੇਢ ਸੌ ਰੁਪਏ ਕਿੱਲੋ ਲਾਉਂਗੇ ਤੁਸੀਂ ਗਜਰੇਲਾ ਢਾਈ ਸੌ ਬਾਕੀ ਡੇਢ ਸੌ ਲੱਗ ਜਾਣਗੀਆਂ ਆਈਟਮਾਂ ਜਿਹੜੀਆਂ ਹੈਗੀਆਂ ਨੇ ਠੀਕ ਆ ਜੀ ਆਪਾਂ ਨੂੰ ਦੋ ਸੌ ਬੰਦੇ ਦਾ ਚਾਹੀਦਾ ਹੈ ਉਹਦੇ ਲਈ ਕੁਛ ਨਾ ਕੁਛ ਰੇਟ ਤੁਸੀਂ ਹੋਰ ਜਾਇਜ਼ ਕਰੋ ਹਾਂਜੀ ਰੇਟ ਥੋੜ੍ਹਾ ਬਹੁਤਾ ਦੇਖੋ ਕੀ ਹੋ ਸਕਦਾ ਹੋਰ ਠੀਕ ਆ ਅਤੇ ਗਜਰੇਲਾ ਫਿਰ ਤੁਸੀਂ ਦੋ ਸੌ ਰੁਪਏ ਲਾ ਦੂੰਗੇ ਠੀਕ ਆ ਅਤੇ ਕੁਆਲਿਟੀ ਵਾਈਜ਼ ਕੋਈ ਅਸੀਂ ਕੰਪਰੋਮਾਈਜ਼ ਨਹੀਂ ਕਰਾਂਗੇ ਤੁਹਾਡੇ ਨਾਲ਼ ਕੁਆਲਿਟੀ ਇੱਕ ਨੰਬਰ ਹੋਣੀ ਚਾਹੀਦੀ ਇਹਦੀ

ਇਸ ਤੋਂ ਇਲਾਵਾ ਹੋਰ ਤੁਹਾਡੇ ਕੋਲ ਮਿੱਠੇ ਵਿੱਚ ਹਾਂ ਠੀਕ ਆ ਇਹੀ ਚੀਜ਼ਾਂ ਚੱਲਦੀਆਂ ਨੇ ਠੀਕ ਆ ਜੀ ਅਤੇ ਠੀਕ ਆ ਸਰ ਇਹ ਫਿਰ ਸਾਡਾ ਅਸੀਂ ਹੋਰ ਵੀ ਇੱਕ ਦੋ ਜਗ੍ਹਾ ਬੀਕਾਨੇਰ ਵਾਲਿਆਂ ਦੇ ਵੀ ਗਏ ਸੀਗੇ ਅਤੇ ਉਹਨਾਂ ਦੇ ਵੀ ਰੇਟ ਅਸੀਂ ਤੁਹਾਡੇ ਰੇਟ ਸਾਨੂੰ ਥੋੜ੍ਹੇ ਜਿਹੇ ਠੀਕ ਲੱਗ ਰਹੇ ਨੇ ਉਹਨਾਂ ਨਾਲੋਂ ਹਾਂ ਇਸ ਲਈ ਅਸੀਂ ਤੁਹਾਨੂੰ ਇਹ ਔਡਰ ਕਰਨਾ ਚਾਹੁੰਦੇ ਹਾਂ ਠੀਕ ਆ ਜੀ ਇਹ ਸਾਡਾ ਔਡਰ ਫਿਰ ਫਾਈਨਲ ਕਰੋ ਤੁਸੀਂ